ਪੰਛੀਆਂ ਦੀ ਬਹੁਤ ਉ ਉਡਾਣ ਉੱਚੀ ਹੁੰਦੀ ਹੈ ਇਹ ਪੰਛੀ ਆਪਣੇ ਆਪਣੇ ਤਰੀਕੇ ਨਾਲ ਉੱਡਦੇ ਹਨ ਜਿਵੇਂ ਕਿ ਬਾਜ ਹੈ ਹੌਲੀ ਹੌਲੀ ਹੌਲੀ ਉੱਡਦਾ ਹੈ ਕਾਂ ਹੈ ਉਹ ਵੀ ਹੌਲੀ ਹੌਲੀ ਹੌਲੀ ਹੌਲੀ ਉੱਡਦਾ ਉੱਡਦਾ ਤੇਜ਼ ਹੋ ਜਾਂਦਾ ਚਿੜੀ ਆ ਉਹ ਵੀ ਹੌਲੀ ਹੌਲੀ ਉੱਡਦੀ ਤੇਜ਼ ਹੋ ਜਾਂਦੀ ਆ ਅਤੇ ਜਿਵੇਂ ਕਿ ਕੱਬਾ ਤੋਤਾ ਹੈ ਉਹ ਵੀ ਹੌਲੀ ਹੌਲੀ ਉੱਡਦਾ ਆਪਣੇ ਖੰਭ ਖਿਲਾਰਦਾ ਹੈ ਬੈਠਦਾ ਹੈ ਹੌਲੀ ਹੌਲੀ ਆਪਣੇ ਖੰਭ ਖਿਲਾਰਦਾ ਹੈ ਫਿਰ ਉੱਡਦਾ ਹੈ ਇਸ ਤਰ੍ਹਾਂ ਪੰਛੀ ਆਪਣੀ ਆਪਣੀ ਉਡਾਣ ਭਰਦੇ ਹਨ ਪੰਛੀਆਂ ਨੂੰ ਆਪਣੇ ਆਪਣੇ ਅੰਦਾਜ ਨਾਲ ਹੀ ਦਾਇਨਾਦ ਵੀ ਉੱਡਦੇ ਹਨ ਜਿਵੇਂ ਕਿ ਚਿੜੀਆਂ ਔਰ ਚਿੜੀ ਹੋ ਗਈ ਕਾਂ ਹੋ ਗਿਆ ਜੇ ਆਪਣੇ ਆਪਣੇ ਆਲ੍ਹਣਿਆਂ ਵਿੱਚ ਸ਼ਾਮ ਨੂੰ ਚਲ ਜਾਂਦੇ ਹਨ ਅਤੇ ਸਾਰਾ ਦਿਨ ਉੱਡਦੇ ਹਨ ਕਦੀ ਇੱਧਰ ਕਦੇ ਉੱਧਰ ਲੰਬੀਆਂ ਲੰਬੀਆਂ ਉਡਾਨਾਂ ਭਰਦੇ ਹਨ ਉਡਾਨਾਂ ਭਰਦੇ ਹਨ ਕਦੇ ਇੱਧਰ ਕਦੀ ਉੱਧਰ ਲੋ ਅਤੇ ਕਬੂਤਰ ਹੋ ਗਿਆ ਉਹ ਵੀ ਬਹੁਤ ਉੱਚੀ ਉੱਚੀ ਉਡਾਨ ਭਰਦਾ ਹੈ ਬਾਜ ਹੋ ਗਿਆ ਬਹੁਤ ਉੱਚੀਆਂ ਉੱਚੀਆਂ ਉਡਾਨਾਂ ਭਰਦੇ ਹਨ